ਰੂਪਨਗਰ ਦੇ ਵਿੱਚ ਕਈ ਸਾਰੇ ਚੈਰਿਟੀ ਜਾਂ ਭਾਇਰਚ ਭਾਈਚਾਰਕ ਸੰਸਥਾਵਾਂ ਹਨ ਜਿਹਨਾਂ ਵਿੱਚੋਂ ਇੱਕ ਸੰਸਥਾ ਇਹੋ ਜਿਹੀ ਵੀ ਹੈਗੀ ਹੈ ਜੋ ਕਿ ਗੁਰਦੁਆਰਿਆਂ ਵਿੱਚ ਲੰਗਰ ਕਰਵਾਉਣ ਦਾ ਸ ਸਮਰਥਨ ਰੱਖਦੀ ਹੈ ਇਹ ਜ਼ਿਲ੍ਹੇ ਵਿੱਚ ਬਹੁਤ ਸਾਰਾ ਫ਼ਰਕ ਲਿਆਉਂਦੀਆਂ ਹਨ ਕਿਉਂਕਿ ਇਹ ਲੋਕਾਂ ਨੂੰ ਆਪਸ ਵਿੱਚ ਇਕੱਠਾ ਕਰਦੀ ਹੈ ਜਿਸ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਇਸਦਾ ਸਮਰਥਨ ਕਰਦੇ ਹਨ ਅਤੇ ਇਹ ਸਮਾਜ ਦੇ ਵਿੱਚ ਕਾਫ਼ੀ ਸਮਾਂ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਸਾਡੇ ਨੇੜੇ ਦੇ ਬਹੁਤ ਸਾਰੇ ਬੁਢਾਪਾ ਘਰ ਬਾਲ ਸੰਭਾਲ ਜਾਂ ਪਾਲਣ ਪੋਸ਼ਣ ਘਰ ਹਨ ਜਿਨ੍ਹਾਂ ਵਿੱਚ ਬਹੁਤ ਸਾਰੀ ਸੰਸਥਾਵਾਂ ਦਾ ਯੋਗਦਾਨ ਹੈ ਕਈ ਲੋਕ ਬੇਘਰ ਹਨ ਜਿਨ੍ਹਾਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਵੱਧਦੀ ਜਾਂਦੀ ਹੈ